ਮੋਹਾਲੀ ਜ਼ਿਲ੍ਹੇ ਵਿੱਚ ਵੈਸੇ ਤਾਂ ਬਹੁਤ ਹੀ ਹੋਸਪਿਟਲ ਬਹੁਤ ਵਧੀਆ ਹਨ ਜਿਵੇਂ ਮੋਹਾਲੀ ਛੇ ਫੇਸ ਅਜੀਤ ਹੋਸਪਿਟਲ ਹੋ ਗਿਆ ਖਰੜ ਸਰਕਾਰੀ ਹੋਸਪਿਟਲ ਹੋ ਗਿਆ ਆਹ ਸੋਹਾਣਾ ਆਪਣੇ ਹੋਸਪਿਟਲ ਸਰਕਾਰੀ ਹੋ ਗਿਆ ਖਰੜ ਦਾ ਹੋਸਪਿਟਲ ਸਰਕਾਰੀ ਹੋ ਗਿਆ ਕੁਰਾਲੀ ਵੀ ਸਰਕਾਰੀ ਹੋਸਪਿਟਲ ਹੈ ਇਨ੍ਹਾਂ ਵਿੱਚ ਬਹੁਤ ਹੀ ਸਹੂਲਤਾਂ ਵਧੀਆ ਹਨ ਇਨ੍ਹਾਂ ਦਾ ਸਟਾਫ ਬਹੁਤ ਵਧੀਆ ਹੈ ਇਨ੍ਹਾਂ ਨੇ ਪਿੰਡਾਂ ਵਿੱਚ ਆ ਕੇ ਆ ਕੇ ਕੋਰਵੀ ਕੋਰਵਿਡ ਦੀ ਬਿਮਾਰੀ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਦੱਸਿਆ ਇਨ੍ਹਾਂ ਨੇ ਦੱਸਿਆ ਕਿ ਮੂੰਹ ਨੂੰ ਢੱਕ ਕੇ ਰੱਖੋ ਹੱਥਾਂ ਨੂੰ ਸੈਨਾਟਾਈਜ਼ਰ ਨਾਲ਼ ਅਤੇ ਆਪਣੇ ਇੱਕ ਦੂਜੇ ਦੀ ਦੂਰੀ ਬਣਾ ਕੇ ਰੱਖੋ ਦੂਰੀ ਬਣਾ ਕੇ ਆਪਣੇ ਇੱਕ ਦੂਜੇ ਨਾਲ਼ ਗੱਲਬਾਤ ਦੂਰੋਂ ਕਰਨੀ ਹੈ ਅਤੇ ਬਿਮਾਰੀਆਂ ਬਾਰੇ ਹੋਰ ਵੀ ਕਈ ਸਹੂਲਤਾਂ ਇਨ੍ਹਾਂ ਨੇ ਚੰਗੀ ਤਰ੍ਹਾਂ ਦੱਸੀਆਂ ਪਿੰਡਾਂ ਵਿੱਚ ਆ ਕੇ